ਅਗਰ ਮੇਰੇ ਕੋਲ ਬਹੁਤ ਸਾਰੇ ਪੈਸੇ ਹੁੰਦੇ ਅਗਰ ਮੈਨੂੰ ਕਿਹਾ ਜਾਵੇ ਵੀ ਤੁਸੀਂ ਕਿ ਕਿਸੇ ਵੀ ਕੰਟਰੀ ਜਾ ਸਕਦੇ ਹੋ ਤਾਂ ਮੈਂ ਸਾਰਿਆਂ ਨਾਲੋਂ ਪਹਿਲਾ ਤਾਂ ਪ੍ਰੈਫਰੈਂਸ ਦਊਂਗਾ ਅਮੈਰੀਕਾ ਨੂੰ ਕਿਉਂਕਿ ਅਮੈਰੀਕਾ ਇੱਕ ਵੈਲ ਡੀਵੈਲਪ ਕੰਟਰੀ ਹੈਗੀ ਹੈ ਅਤੇ ਉੱਥੋ ਦੇ ਜਿਹੜੇ ਲੋਕ ਹੈਗੇ ਹੈ ਉਨ੍ਹਾਂ ਦੀ ਚੀਜ਼ ਖਰੀਦਣ ਦੀ ਸ਼ਮਤਾ ਹੈਗੀ ਹੈ ਉਹ ਜਿਹੜਾ ਛੋਟੇ ਤੋਂ ਛੋਟਾ ਬੰਦਾ ਵੀ ਹੈਗਾ ਹੈ ਉਹ ਬੜੀ ਤੋਂ ਬੜੀ ਚੀਜ਼ ਖਰੀਦਣ ਦੀ ਸ਼ਮਤਾ ਰੱਖਦਾ ਹੈਗਾ ਏ ਜਿਹੜੇ ਉੱਥੋਂ ਦੇ ਲੋਕਾਂ ਦਾ ਜੀਵਨ ਜੀਊਣ ਦਾ ਢੰਗ ਹੈਗਾ ਏ ਉਹ ਸਾਡੇ ਜਿਹੜੇ ਭਾਰਤ ਦੇ ਲੋਕਾਂ ਨਾਲੋਂ ਕਾਫੀ ਉੱਚਾ ਹੈਗਾ ਏ ਅਤੇ ਜਿਹੜਾ ਉੱਥੇ ਦਾ ਲਾਈਫ ਸਟਾਈਲ ਹੈ ਜਿਹੜਾ ਉੱਥੇ ਦਾ ਨੰਬਰ ਦੋ 'ਤੇ ਸਾਰਿਆ ਨਾਲੋਂ ਜਿਹੜਾ ਵੱਡਾ ਰੀਜ਼ਨ ਹੈ ਉਹ ਹੈਗਾ ਉੱਥੇ ਦਾ ਐਜੂਕੇਸ਼ਨ ਸਿਸਟਮ ਪੜ੍ਹਾਈ ਉਹ ਸਾਡੇ ਇੱਥੇ ਦੇ ਇੰਡੀਆ ਅਤੇ ਅਮੈਰੀਕਾ ਦੀ ਬਹੁਤ ਜ਼ਿਆਦਾ ਸਿਸ ਓਹਦਾ ਫਰਕ ਹੈਗਾ ਏ ਜੇ ਮੈਨੂੰ ਅਮੈਰੀਕਾ ਤੋਂ ਬਾਅਦ ਕੋਈ ਦੂਜੀ ਓਪਸ਼ਨ ਦਿੱਤੀ ਜਾਵੇ ਵੀ ਤੂੰ ਕਿੱਥੇ ਜਾਊਂਗਾ ਤਾਂ ਮੈਂ ਨੰਬਰ ਦੋ 'ਤੇ ਯੂਰੋਪ 'ਚ ਜਾਣਾ ਪਸੰਦ ਕਰੂੰਗਾ ਕਿਉਂਕਿ ਯੂਰੋਪ ਦੇ ਵਿੱਚ ਤੁਹਾਡਾ ਇੱਕ ਇੱਕ ਕੰਟਰੀ ਦਾ ਵੀਜ਼ਾ ਲੱਗ ਜਾਂਦਾ ਹੈਗਾ ਏ ਤਾਂ ਸ਼ੈਨ ਸ਼ੈਨਗੰਨ ਕੰਟਰੀ ਦੇ ਹਿਸਾਬ ਨਾਲ ਤੁਸੀਂ ਉੱਥੇ ਦੀਆਂ ਜਿਹੜੀਆਂ ਆਲ਼ੇ ਦੁਆਲ਼ੇ ਦੀਆਂ ਕੰਟਰੀਆਂ ਹੈਗੀਆਂ ਛੱਬੀ ਸਤਾਈ ਜਿੰਨੀਆਂ ਵੀ ਹੈਗੀਆਂ ਹੈ ਤੁਸੀਂ ਉਹਨਾਂ ਵਿੱਚ ਬਿਨ੍ਹਾਂ ਵੀਜ਼ੇ ਤੋਂ ਘੁੰਮ ਸਕਦੇ ਆ